ਮੈਨੂੰ ਫੋਟੋਗਰਾਫੀ ਸ਼ੁਰੂ ਕਰਨ ਲਈ ਪ੍ਰੇਰਿਤ ਕਰਨ ਵਾਲੀ ਚੀਜ਼ ਮੇਰੇ ਆਲੇ ਦੁਆਲੇ ਦੀ ਦੁਨੀਆ ਦਾ ਗਹਿਰਾ ਅਧਿਐਨ ਸੀ ਮੈਨੂੰ ਲੱਗਦਾ ਸੀ ਕਿ ਇੱਕ ਤਸਵੀਰ ਸਿਰਫ ਇੱਕ ਪਲ ਦੀ ਗਵਾਈ ਨਹੀਂ ਹੁੰਦੀ ਸਗੋਂ ਇਹ ਭਾਵਨਾਵਾਂ ਤੇ ਕਹਾਣੀਆਂ ਨੂੰ ਵੀ ਕੈਦ ਕਰ ਸਕਦੀ ਹੈ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਮੈਂ ਜ਼ਿੰਦਗੀ ਦੇ ਖੂਬਸੂਰਤ ਅਤੇ ਛੋਟੇ ਪਲਾ ਨੂੰ ਫੋਟੋਸਟੇਟ ਵਿੱਚ ਪਕੜ ਸਕਾ ਜਿਸ ਨਾਲ ਲੋਕਾਂ ਨੂੰ ਹਰ ਇੱਕ ਪਲ ਵਿੱਚ ਖੂਬੀ ਦਿਖਾਈ ਦਿੰਦੀ ਰਹਿ ਦੇ ਸਕੇ ਮੇਰੇ ਟੀਚੇ ਇਹ ਹਨ ਕਿ ਮੈਂ ਹਮੇਸ਼ਾ ਕੁਝ ਨਵਾਂ ਅਤੇ ਨਿਵੇਕ ਵਿਲੱਖਣ ਪੇਸ਼ ਕਰਾਂ ਜਿਸ ਨਾਲ ਜਿਸ ਨਾਲ ਲੈ ਕੇ ਫੋਟੋਗ੍ਰਾਫੀ ਸਿਰਫ ਇੱਕ ਕਲਾ ਨਾ ਸਮਝਾ ਸਗੋਂ ਇਸ ਨੂੰ ਇੱਕ ਸੰਦੇਸ਼ ਦੇ ਅੰਦਰ ਢੰਗ ਵੀ ਦੇਖਣ ਨਾ ਕੁਝ ਖਾਸ ਜਿਵੇਂ ਸ਼ਹਿਰੀ ਜ਼ਿੰਦਗੀ ਅਤੇ ਦੈਨਿਕ ਰੁਟੀਨ ਇਲਾਵਾ ਤੋ ਖੁਦ ਦੇ ਵਿਚਾਰ ਤੇ ਭਾਵਨਾਵਾਂ ਨੂੰ ਆਪਣੇ ਕੰਮ ਵਿੱਚ ਪ੍ਰਗਟ ਦੀ ਕੋਸ਼ਿਸ਼ ਕਰਦਾ ਹੈ